ਹੈਲੋ ਹਾਂਜੀ ਮੈਮ ਗੁਡ ਆਫਟਰਨੂਨ ਬਸ ਵਧੀਆ ਮੈਮ ਹਾਂਜੀ ਮੈਮ ਤੁਹਾਨੂੰ ਕੋਈ ਕਲਾਸ ਦੇ ਵਿੱਚ ਲੈ ਕੇ ਕੋਈ ਦਿੱਕਤ ਤਾਂ ਨਹੀਂ ਕੋਈ ਕੋਈ ਪ੍ਰੋਬਲਮ ਹੋਵੇ ਕੋਈ ਕਲਾਸ 'ਚ ਪੜ੍ਹਾਉਂਦੇ ਹੋਏ ਕੋਈ ਬੋਰਡ ਪ੍ਰੋਬਲਮ

ਅੱਛਾ ਜੀ ਠੀਕ ਹੈ ਠੀਕ ਹੈ ਉਹ ਰੀਫਲੈਕਸ਼ਨ ਜਿਹੀ ਹੋ ਜਾਂਦੀ ਹੋਏਗੀ ਨਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਕੋਈ ਨਹੀਂ ਮੈਮ ਇਸ ਤਰ੍ਹਾਂ ਕਰਾਂਗੇ ਨਾ ਇਲੈਕਟ੍ਰੀਸ਼ਨ ਵਾਲੇ ਨੂੰ ਬੁਲਾ ਕੇ ਤੁਹਾਡੇ ਬੋਰਡ ਦੇ ਉੱਪਰ ਵਾਲੀ ਸਾਈਡ 'ਤੇ ਐਲ ਈ ਡੀ ਜਾਂ ਲਾਈਟ ਵਗੈਰਾ ਲਗਾ ਦਿੱਤੀ ਜਾਏਗੀ ਜਿਹਦੇ ਨਾਲ ਤੁਹਾਡੀ ਇਹ ਪ੍ਰੋਬਲਮ ਖ਼ਤਮ ਹੋ ਜਾਏਗੀ ਹੈ ਨਾ ਹਾਂਜੀ ਹੋਰ ਕੋਈ

ਓਕੇ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਵਾਈ ਫਾਈ ਵਾਈ ਫਾਈ ਦੀ ਪ੍ਰੋਬਲਮ ਹੋ ਸਕਦੀ ਮੈਮ ਕੋਈ ਨਹੀਂ ਉਹ ਵੀ ਬੁਲਾ ਕੇ ਉਹਨੂੰ ਲੜਕੇ ਨੂੰ ਉਹਦੀ ਵਿਜ਼ਿਟ ਕਰਵਾ ਕੇ ਦਿਖਾ ਦਿੱਤਾ ਜਾਏਗਾ ਤੁਹਾਡਾ ਵਾਈ ਫਾਈ ਦੀ ਪ੍ਰੋਬਲਮ ਨੂੰ ਹੱਲ ਕਰ ਦਿੱਤਾ ਜਾਏਗਾ ਹੈ ਨਾ ਅਤੇ ਦੂਸਰਾ ਤੁਹਾਡਾ ਮਾਊਸ ਜਿਹੜਾ ਤੁਸੀਂ ਕਹਿ ਰਹੇ ਹੋ ਅਤੇ ਉਹ ਕੀਪੈਡ ਕਹਿ ਰਹੇ ਹੋ ਅਗਰ ਉਹ 'ਚ ਕੋਈ ਦਿੱਕਤ ਹੋਏਗੀ ਤਾਂ ਉਹ ਚੇਂਜ ਕਰਵਾ ਦਿੱਤੇ ਜਾਣਗੇ ਅ ਨਿਊ ਪ੍ਰੋਵਾਈਡ ਕਰਵਾ ਦੇਵਾਂਗੇ ਹੈ ਨਾ ਓਕੇ ਜੀ ਓਕੇ ਓਕੇ ਓਕੇ ਮੈਮ ਓਕੇ